ਮੈਂ ਮੀਸ਼ੋ ਐਪ ਯੂਜ ਕਰਦੀ ਹਾਂ ਮੈਂ ਮੀਸ਼ੋ ਐਪ ਤੋਂ ਇੱਕ ਕੁੜਤੀ ਮੰਗਵਾਈ ਸੀ ਅਤੇ ਉਹ ਕੁੜਤੀ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ ਉਸ ਦੇ ਨਾਲ ਦੀ ਕੁੜਤੀ ਮੈਂ ਦੁਕਾਨ 'ਤੇ ਦੇਖੀ ਸੀ ਪਰ ਉੱਥੇ ਉਹ ਮੈਨੂੰ ਬਹੁਤ ਜ਼ਿਆਦਾ ਮਹਿੰਗੀ ਲੱਗੀ ਅਤੇ ਜਦੋਂ ਮੈਂ ਵੀ ਮੀਸ਼ੋ ਮੀਸ਼ੋ ਐਪ ਤੋਂ ਉਹ ਕਮੀਜ਼ ਮੰਗਵਾਈ ਤਾਂ ਉਹ ਮੈਨੂੰ ਬਹੁਤ ਸਸਤੀ ਪੈ ਗਈ ਅਤੇ ਉਹ ਬਹੁਤ ਹੀ ਅੱਛੀ ਹੈ ਉਸ ਦੀ ਫਿਟਿੰਗ ਬਹੁਤ ਵਧੀਆ ਆਈ ਮੈਨੂੰ ਮੇਰੀਆਂ ਫਰੈਂਡਸ ਨੇ ਪੁੱਛਿਆ ਕਿ ਤੂੰ ਇਹ ਕਿੱਥੋਂ ਮੰਗਵਾਈ ਹੈ ਤਾਂ ਮੈਂ ਉਹਨਾਂ ਨੂੰ ਮੀਸ਼ੋ ਐਪ ਬਾਰੇ ਦੱਸਿਆ ਅਤੇ ਉਹਨਾਂ ਨੇ ਵੀ ਉੱਥੋਂ ਚੀਜ਼ਾਂ ਮੰਗਵਾਈਆਂ ਮੀਸ਼ੋ ਐਪ ਤੋਂ ਮੈਨੂੰ ਮੈਂ ਹੋਰ ਵੀ ਬਹੁਤ ਕੁਝ ਮੰਗਵਾਉਂਦੀ ਹਾਂ ਮੈਨੂੰ ਕਮੀਜ਼ ਦੀ ਕਮੀਜ਼ ਮੈਂ ਕਮੀਜ਼ ਧੋ ਵੀ ਲਿਆ ਅਤੇ ਉਸ ਦਾ ਕਲਰ ਬਿਲਕੁਲ ਵੀ ਨਹੀਂ ਗਿਆ ਅਤੇ ਉਹ ਕਮੀਜ਼ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿਸੇ ਨੇ ਮੇਰਾ ਨਾਪ ਲੈ ਕੇ ਹੀ ਉਹ ਕਮੀਜ਼ ਮੇਰੇ ਲਈ ਹੀ ਬਣਾਇਆ ਹੋਵੇ